ਭਾਰਤ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ ਅਤੇ ਲੋਕਤੰਤਰ ਦੇ ਵਿੱਚ ਇਹ ਸਰਕਾਰ ਤਿੰਨ ਭਾਗਾਂ 'ਚ ਕੰਮ ਕਰਦੀ ਆ ਵਿਧਾਨ ਪਾਲਿਕਾ ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਵਿਧਾਨ ਪਾਲਿਕਾ ਦੱਸਦੀ ਹੈ ਕਿ ਕਿਸ ਅਕੋਰਡਿੰਗ ਕੰਮ ਹੋਣਾ ਕਾਰਜ ਪਾਲਿਕਾ ਉਸ 'ਤੇ ਅਮਲ ਕਰਦੀ ਹੈ ਅਤੇ ਨਿਆਂ ਪਾਲਿਕਾ ਇਹ ਤੈਅ ਕਰਦੀ ਹੈ ਕਿ ਕਿਹੜਾ ਨਿਯਮ ਦੇ ਦੇ ਅਨੁਸਾਰ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਇਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਵਕਤ ਆਪ ਦੀ ਸਰਕਾਰ ਹੈ ਪਹਿਲਾਂ ਉਰੇ ਅਕਾਲੀ ਦਲ ਦਾ ਰਿਹਾ ਫਿਰ ਕਾਂਗਰਸ ਨੇ ਵੀ ਆਪਣੇ ਪੈਰ ਜਮਾਏ ਨੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪ ਨੂੰ ਇੱਕ ਮੌਕਾ ਦਿੱਤਾ ਆਪ ਦੀ ਸਰਕਾਰ ਜੋ ਕਿ ਆਪਣੇ ਕਾਰਜ ਭੂਮਿਕਾ ਹੁਣ ਕਰ ਰਹੀ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਦੀ ਉਮੀਦਾਂ 'ਤੇ ਖਰਾ ਉਤਰ ਪਾਉਂਦੀ ਹੈ ਕਿ ਨਹੀਂ ਅਸਲ ਵਿੱਚ ਜਿਹੜੀ ਸਰ ਉਰੇ ਭਾਰਤ ਵਿੱਚ ਜਿਹੜੀ ਸਰਕਾਰ ਹੈ ਇਹਦੇ ਵਿੱਚ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਹੁੰਦੀ ਆ ਆਪਣੀ ਕੇਂਦਰ ਦੇ ਵਿੱਚ ਜੋ ਸਰਕਾਰ ਹੈ ਉਹ ਹੈ ਭਾਜਪਾ ਦੀ ਅਤੇ ਪੰਜਾਬ ਵਿੱਚ ਆਪ ਹੈ ਸੋ ਇਸ ਤਰ੍ਹਾਂ ਜੋ ਹੁੰਦਾ ਕਿ ਕਿਸੇ ਵੀ ਸਰਕਾਰ ਨੂੰ ਕੰਮ ਕਰਨ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਕਿਉਂਕਿ ਜੋ ਸਰਕਾਰ ਕੇਂਦਰ ਵਿੱਚ ਹੈ ਉਸ ਨਾਲ ਫਿਰ ਸੰਪਰਕ ਕਰਨ ਵਿੱਚ ਉਸਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਇਸ ਤਰ੍ਹਾਂ ਹੀ ਜੋ ਇਸ ਵਾਰ ਜੋ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੋਏ ਨੇ ਉਸ ਵਿੱਚ ਪੰਜਾਬ ਦੀ ਜੋ ਜਨਤਾ ਹੈ ਉਸਨੇ ਕਾਂਗਰਸ ਨੂੰ ਜ਼ਿਆਦਾ ਸੀਟਾਂ ਦਿੱਤੀਆਂ ਨੇ ਜਦੋਂ ਕਿ ਆਪ ਜੋ ਮੈਨੂੰ ਲੱਗਦਾ ਤਿੰਨ ਅਤੇ ਕਾਂਗਰਸ ਸੱਤ ਇਸ ਤਰ੍ਹਾਂ ਨਿਬੜ ਗਈ ਹੈ ਜੋ ਕਿ ਦੇਖੋ ਆਉਣ ਵਾਲੇ ਸਮੇਂ 'ਚ ਬਦਲਾਅ ਦਾ ਸੂਚਕ ਹੈ ਚੱਲੋ ਇਸ ਤਰ੍ਹਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦਾ ਭਲਾ ਹੋਣਾ ਚਾਹੀਦਾ ਪੂਰੇ ਭਾਰਤ ਦਾ ਭਲਾ ਹੋਣਾ ਚਾਹੀਦਾ ਧੰਨਵਾਦ